ਖੇਤੀਬਾੜੀ ਜਿਹੜਾ ਵਿਦੇਸ਼ੀ ਵਪਾਰ ਦਾ ਇਕ ਬਹੁਤ ਵੱਡਾ ਸਾਧਨ ਹੈ ਜਿਸ ਨਾਲ ਸਾਡਾ ਪੰਜਾਬ ਦਾ ਪੰਜਾਬ ਦੀਆਂ ਆਰਥਿਕ ਜ਼ਰੂਰਤਾਂ ਅਤੇ ਦੇਸ਼ ਦੀ ਤਰੱਕੀ ਲਈ ਬਾਹਰਲੇ ਦੇਸ਼ਾਂ ਤੋਂ ਚੀਜ਼ਾਂ ਮੰਗਵਾਉਂਦੇ ਹਾਂ ਖੇਤੀਬਾੜੀ ਕਿਸਾਨਾਂ ਦੇ ਇੱਕ ਮੁੱਖ ਉ ਔਜ਼ਾਰ ਹੈ ਕਿੱਤਾ ਹੈ ਜਿਸ ਨਾਲ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਸਾਡਾ ਜਿਹੜਾ ਪੰਜਾਬ ਦਾ ਖੇਤੀਬਾੜੀ ਸੈਕਟਰ ਹੈ ਉਹ ਦੂਜੇ ਸੈਕਟਰਾਂ ਨਾਲੋਂ ਸਹਿਯੋਗ ਕਰਦਾ ਹੈ ਕਿਉਂਕਿ ਜਿਹੜੀਆਂ ਬਾਹਰਲੀਆਂ ਕੰਟਰੀਆਂ ਹੁੰਦੀਆਂ ਹਨ ਉਹ ਸਾਨੂੰ ਖੇਤੀਬਾੜੀ ਦੇ ਉਦਯੋਗ ਵਿੱਚ ਸਹਾਈ ਕਾਫੀ ਸਹਾਇਤਾ ਕਰਦੀਆਂ ਹਨ ਕਿਉਂਕਿ ਜਿਹੜਾ ਸਾਡਾ ਪੰ ਪੰਜਾਬ ਹੈ ਉਹ ਖੇਤੀਬਾੜੀ ਦੇ ਕਾਫੀ ਉਚਾਰ ਸੈਨਿਕ ਖਾਦਾਂ ਬਾਹਰਲੇ ਦੇਸ਼ਾਂ ਤੋਂ ਮੰਗਵਾਉਂਦੇ ਹਨ ਕਿ ਅਤੇ ਸਾਡਾ ਪੰਜਾਬ ਤਰੱਕੀ ਵੱਲ ਜਾ ਕੇ ਇਸ ਕਰਕੇ ਪੰਜਾਬ ਦੇ ਬਾਹਰਲੇ ਦੇਸ਼ਾਂ ਦੇ ਵਿਚਕਾਰ ਕਾਫੀ ਸਹਿਯੋਗ ਜਾਂ ਭਾਈਵਾਲ ਬਣੀ ਰਹਿੰਦੀ ਹੈ ਇਸ ਨਾਲ ਦੇਸ਼ ਦੀ ਆਰਥਿਕ ਤਰੱਕੀ ਵੀ ਹੁੰਦੀ ਹੈ ਅਤੇ ਇਸ ਨਾਲ ਦੇਸ਼ ਤੋਂ ਬਾਹਰਲੇ ਦੇਸ਼ਾਂ ਤੋਂ ਸਾਨੂੰ ਰੋਜ਼ਗਾਰ ਵੀ ਮਿਲਦਾ ਹੈ